ਜੇਕਰ ਅਸੀਂ ਬੱਚਿਆਂ ਦੀਆਂ ਗੇਮਾਂ ਬਾਰੇ ਗੱਲ ਕਰੀਏ ਜਿਵੇਂ ਕਿ ਬੱਚੇ ਅੱਜ ਕੱਲ੍ਹ ਦੇ ਜ਼ਿਆਦਾ ਕਰਕੇ ਗੇਮਾਂ ਮੋਬਾਇਲ 'ਤੇ ਹੀ ਖੇਡਦੇ ਹਨ ਉਹ ਬਹੁਤ ਹਾਨੀਕਾਰਕ ਆ ਸਾਨੂੰ ਮਾਂ ਬਾਪਾਂ ਨੂੰ ਜ਼ਿਆਦਾ ਕਰਕੇ ਬੱਚਿਆਂ ਵੱਲ ਧਿਆਨ ਦੇਣਾ ਚਾਹੀਦਾ ਹੈ ਬੱਚਿਆਂ ਦੀ ਏ ਨਿਗ੍ਹਾਂ ਘੱਟਦੀ ਹੈ ਮੋਬਾਇਲ 'ਤੇ ਖੇਡਣ ਨਾਲ਼ ਅਤੇ ਹੋਰ ਦਿਮਾਗੀ ਪਰੇਸ਼ਾਨੀਆਂ ਹੁੰਦੀਆਂ ਹਨ ਅਤੇ ਬੱਚਿਆਂ ਨੂੰ ਮੈਂਟਲੀ ਐਵਸੈੱਟ ਹੋ ਜਾਂਦੇ ਹਨ ਸਾਨੂੰ ਆਪਣੇ ਬੱਚਿਆਂ ਨੂੰ ਗਰੌਂਡ ਵਿੱਚ ਲੈ ਕੇ ਜਾਣਾ ਚਾਹੀਦਾ ਹੈ ਉੱਥੇ ਜਾ ਕੇ ਕਬੱਡੀ ਖੋ ਖੋ ਹੋਰ ਫੁੱਟਬੋਲ ਵਗੈਰਾ ਵਾਲੀਵੋਲ ਵਗੈਰਾ ਖਲਾਉਣੀ ਚਾਹੀਦਾ ਹੈ ਜਿਵੇਂ ਕਿ ਬੱਚਿਆਂ ਵਿੱਚ ਤਾਕਤ ਵੀ ਵੱਧਦੀ ਹੈ ਅਤੇ ਹੱਡੀਆਂ ਵੀ ਮਜ਼ਬੂਤ ਹੁੰਦੀਆਂ ਹਨ ਸਾਨੂੰ ਆਪਣੇ ਬੱਚਿਆਂ ਦਾ ਵੱਧ ਤੋਂ ਵੱਧ ਧਿਆਨ ਦੇਣਾ ਚਾਹੀਦਾ ਹੈ